ਅੱਜ ਕੱਲ੍ਹ ਪੇਂਡੂ ਖੇਤਰਾਂ ਵਿੱਚ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਭ ਤੋਂ ਪਹਿਲੇ ਮੌਸਮ ਸਭ ਤੋਂ ਉੱਤੇ ਹੈ ਕਿਉਂਕਿ ਕਿਸਾਨ ਕਈ ਕਾਫ਼ੀ ਮਿਹਨਤ ਕਰਕੇ ਫਸਲ ਬੀਜਦਾ ਹੈ ਅਤੇ ਕਈ ਵਾਰ ਮੌਸਮ ਜਿਵੇਂ ਕਿ ਮੀਂਹ ਪੈਣ ਕਰਕੇ ਉਹਨਾਂ ਦੀ ਫਸਲ ਖ਼ਰਾਬ ਹੋ ਜਾਂਦੀ ਹੈ ਜਿਸ ਕਰਕੇ ਉਨ੍ਹਾਂ ਦੀ ਸਾਰੀ ਮਿਹਨਤ ਖ਼ਰਾਬ ਹੋ ਜਾਂਦੀ ਹੈ ਉਸ ਤੋਂ ਬਾਅਦ ਉ ਉਹਨਾਂ ਨੂੰ ਉਨ੍ਹਾਂ ਦੀ ਫਸਲਾਂ ਦਾ ਕਈ ਵਾਰ ਢੁੱਕਵਾਂ ਜੋ ਵੀ ਉਹਨਾਂ ਨੂੰ ਐੱਮ ਐੱਸ ਪੀ ਚਾਹੀਦੀ ਹੈ ਉਹਨਾਂ ਨੂੰ ਮੁੱਲ ਜੋ ਫਸਲਾਂ ਦਾ ਚਾਹੀਦਾ ਉਹ ਉਹਨਾਂ ਨੂੰ ਉਨਾਂ ਨਹੀਂ ਮਿਲ ਪਾਉਂਦਾ ਉਸ ਤੋਂ ਬਾਅਦ ਉਹਨਾਂ ਨੂੰ ਟ੍ਰਾਂਸਪੋਟੇਸ਼ਨ ਦਾ ਵੀ ਇਹ ਟ੍ਰਾਂਸਪੋਟੇਸ਼ਨ ਦਾ ਵੀ ਮੁੱਦਾ ਆਉਂਦਾ ਹੈ ਅਤੇ ਵਿੱਤੀ ਸਹਾਇਤਾ ਵੀ